ਨਹੀਂ ਮੈਂ ਉੱਚਾਈਆਂ ਤੋਂ ਨਹੀਂ ਡਰਦੀ ਬਲਕਿ ਮੈਨੂੰ ਉੱਚਾਈ 'ਤੇ ਜਾਣਾ ਪਹਾੜਾਂ ਦੇ ਵਿੱਚ ਜਾਣਾ ਟਰੈਕਿੰਗ ਕਰਨੀ ਬਹੁਤ ਹੀ ਜ਼ਿਆਦਾ ਪਸੰਦ ਹੈ ਮੈਨੂੰ ਘੁੰਮਣਾ ਫਿਰਨਾ ਬਹੁਤ ਪਸੰਦ ਹੈ ਖਾਸ ਕਰਕੇ ਪਹਾੜਾਂ ਦੇ ਵਿੱਚ ਉੱਚਾਈ 'ਤੇ ਜਾਣਾ ਟਰੈਕਿੰਗ ਕਰਨੀ ਇਹ ਸਾਰੀਆਂ ਚੀਜ਼ਾਂ ਮੈਨੂੰ ਬਹੁਤ ਪਸੰਦ ਹੈ ਮੈਨੂੰ ਕਦੇ ਵੀ ਉੱਚਾਈ ਤੋਂ ਫੋਬੀਆ ਨਹੀਂ ਹੋਇਆ ਇਸ ਕਰਕੇ ਮੈਨੂੰ ਚੜ੍ਹਨ ਤੋਂ ਉੱਪਰ ਚੜ੍ਹਨ ਤੋਂ ਜਾਂ ਚੜ੍ਹਾਈ ਤੋਂ ਉੱਚਾਈ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਫੋਬੀਆ ਨਹੀਂ ਹੈਗਾ